ਅਖ਼ਬਾਰ ਸਵੇਰੇ ਸਵੇਰੇ ਸਾਡੇ ਘਰਾਂ ਵਿੱਚ ਆ ਜਾਂਦੀਆਂ ਹਨ ਜੋ ਕਿ ਹਰ ਕੋਈ ਇਸਨੂੰ ਬੜੇ ਚਾਅ ਨਾਲ ਪੜ੍ਹਦਾ ਹੈ ਪਰ ਹੁੰਦਾ ਸਭ ਕੁਝ ਇਹਦੇ 'ਤੇ ਝੂਠ ਹੀ ਹੈ ਅਤੇ ਸੱਚਾਈ ਨਾਲੋਂ ਕਾਫ਼ੀ ਫਰਕ ਹੁੰਦਾ ਹੈ ਅਖ਼ਬਾਰਾਂ ਸਵੇਰੇ ਸਵੇਰੇ ਲੋਕ ਅਜੀਤ ਅਖ਼ਬਾਰ ਜਗਬਾਣੀ ਦੈਨਿਕ ਜਾਗਰਣ ਹਿੰਦੀ ਵਿੱਚ ਵੀ ਹੁੰਦੀਆਂ ਹਨ ਅਤੇ ਇੰਗਲਿਸ਼ ਵਿੱਚ ਵੀ ਹੁੰਦੀਆਂ ਹਨ ਸਾਰੇ ਇਹਨੂੰ ਬੜੇ ਚਾਅ ਨਾਲ ਪੜ੍ਹਦੇ ਹਨ ਪਰ ਇਹਦੇ 'ਤੇ ਤੁਸੀਂ ਅਖ਼ਬਾਰਾਂ 'ਤੇ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ ਅਤੇ ਜੋ ਮੈਗਜੀਨ ਹੁੰਦੇ ਹਨ ਮੈਗਜੀਨ ਕਮਰਸ਼ੀਅਲ ਤੋਰ 'ਤੇ ਨਿਊਜਾਂ ਨਾਲ ਅਪਡੇਟ ਹੁੰਦੇ ਹਨ ਅਤੇ ਇਹ ਸਾਡੇ ਘਰਾਂ ਵਿੱਚ ਹਫ਼ਤੇ ਹਫ਼ਤੇ ਬਾਅਦ ਆਉਂਦੇ ਹਨ ਪਰ ਇਹਨਾਂ 'ਤੇ ਨਿਊਜ ਘੱਟ ਅਤੇ ਫੋਟੋਆਂ ਜ਼ਿਆਦਾ ਹੁੰਦੀਆਂ ਹਨ ਪਰ ਤੁਸੀਂ ਇਹਨਾਂ 'ਤੇ ਵਿਸ਼ਵਾਸ ਨਹੀਂ ਕਰ ਸਕਦੇ ਨਿਊਜ ਚੈਨਲ ਜਿਹੜੇ ਹੁੰਦੇ ਹਨ ਉਹ ਸਭ ਆਮ ਤੌਰ 'ਤੇ ਵਿਕਾਊ ਹੀ ਹੁੰਦੇ ਹਨ ਕਿਉਂਕਿ ਇਹ ਕੁਝ ਵੀ ਸੱਚ ਤਾਂ ਨਹੀਂ ਦੱਸ ਸਕਦੇ ਇਹ ਆਪਣੀ ਪੀ ਆਰ ਪੀ ਲੈਣ ਵਾਸਤੇ ਵੱਧ ਤੋਂ ਵੱਧ ਮਲ ਕਿ ਤੁਹਾਨੂੰ ਮਸਾਲੇ ਲਾ ਲਾ ਕੇ ਦੱਸਦੇ ਹਨ ਅਤੇ ਸੱਚਾਈ ਨਾਲੋਂ ਬਹੁਤ ਫਰਕ ਹੁੰਦਾ ਹੈ ਅਤੇ ਰਹੀ ਗੱਲ ਸ਼ੋਸ਼ਲ ਮੀਡੀਆ ਦੀ ਸ਼ੋਸ਼ਲ ਮੀਡੀਆ 'ਤੇ ਫਿਰ ਵੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿਉਂਕਿ ਇਹਦੇ 'ਤੇ ਆਮ ਨਾਗਰਿਕ ਵੀ ਲਾਇਵ ਹੋ ਕੇ ਆਪਣੇ ਹੱਕ ਦੀ ਆਵਾਜ਼ ਲੈ ਕੇ ਤੁਹਾਨੂੰ ਸੱਚ ਦੱਸ ਸਕਦਾ ਹੈ ਧੰਨਵਾਦ